ਇਹ ਪਹਿਲਾਂ ਨਾਲੋਂ ਜਿਹੜਾ ਮੌਸਮ ਹੈ ਬਹੁਤ ਬਦਲਾਅ 'ਚ ਆਇਆ ਪਿਆ ਵੀ ਇਹ ਮੌਸਮ ਜਿਹੜਾ ਪਹਿਲਾਂ ਸੀਗਾ ਉਹ ਟਾਈਮ ਸਿਰ 'ਤੇ ਰੁੱਤ ਸਿਰ ਬਾਰਿਸ਼ ਪੈਂਦੀ ਸੀ ਅਤੇ ਰੁੱਤ ਸਿਰ 'ਤੇ ਹੀ ਠੰਡ ਪੈਂਦੀ ਸੀਗੀ ਅਤੇ ਹਿਸਾਬ ਦੇ ਹੀ ਗਰਮੀ ਪੈਂਦੀ ਸੀਗੀ ਜਿਹੜਾ ਹੁਣ ਬਦਲਾਅ ਆਇਆ ਇਹ ਬਹੁਤ ਵੀ ਜ਼ਿਆਦਾ ਹੈ ਵੀ ਨਾ ਤਾਂ ਕੋਈ ਮੀਂਹ ਬਾਰਿਸ਼ ਵੀ ਟਾਈਮ ਸਿਰ 'ਤੇ ਹੁੰਦੀ ਹੈ ਨਾ ਕੋਈ ਗਰਮੀਆਂ ਉਹ ਵੀ ਹੱਦੋਂ ਵੱਧ ਪੈ ਰਹੀ ਹੈ ਅਤੇ ਠੰਡ ਵੀ ਹੱਦੋਂ ਵੱਧ ਪੈ ਰਹੀ ਹੈ ਜਦੋਂ ਸੁਣਦੇ ਹਾਂ ਖਬਰਾਂ ਦੇ ਵਿੱਚ ਵੀ ਸੁਣਦੇ ਹਾਂ ਅਤੇ ਦੇਖੇ ਟੀਵੀ ਮੋਬਾਈਲਾਂ 'ਤੇ ਵੀ ਸੁਣਦੇ ਆ ਵੀ ਪਿਛਲੀਆਂ ਗਰਮੀਆਂ ਨਾਲੋਂ ਸਰਦੀਆਂ ਨਾਲੋਂ ਵੀ ਰਿਕਾਰਡ ਟੁੱਟੇ ਹੈ ਠੰਡ ਦੇ ਵੀ ਕਹਿ ਦਿੰਦੇ ਹੈ ਅਤੇ ਗਰਮੀ ਦੇ ਵੀ ਕਹਿ ਦਿੰਦੇ ਹੈ ਆਏ ਸਾਲ ਬਦਲਾਅ ਜ਼ਿਆਦਾ ਗਰਮੀ ਦਾ ਵੀ ਅਤੇ ਸਰਦੀ ਦਾ ਵੀ ਅਤੇ ਬਾਰਿਸ਼ਾਂ ਵੀ ਹੱਦੋਂ ਵੱਧ ਹੀ ਪੈਂਦੀਆਂ ਜਦੋ ਪੈਂਦੀਆਂ ਟਾਈਮ 'ਤੇ ਨਹੀਂ ਪੈਂਦੀਆਂ ਪੱਕੀਆਂ ਫਸਲਾਂ ਦੇ ਉੱਤੇ ਗੜੇਮਾਰੀ ਹੋਣੀ ਅਤੇ ਪੱਕੀਆਂ ਫਸਲਾਂ ਅਤੇ ਹੜ੍ਹ ਆਉਣੇ ਅਤੇ ਬਹੁਤ ਪਿੱਛੇ ਹੜ੍ਹ ਆਏ ਸੀ ਅਤੇ ਬਹੁਤ ਨਿਸ਼ਕਾਣ ਫਸਲਾਂ ਦਾ ਵੀ ਹੋਇਆ ਪਸ਼ੂਆਂ ਦਾ ਵੀ ਹੋਇਆ ਅਤੇ ਬੰਦਿਆਂ ਦਾ ਵੀ ਹੋਇਆ ਇਸ ਗੱਲ ਨੂੰ ਲੈ ਕੇ ਅਤੇ ਬਹੁਤ ਬਦਲਾਅ ਦੇ ਵਿੱਚ ਵੀ ਉਹ ਹੈ ਆਇਆ ਵੀ ਬਹੁਤ ਜ਼ਿਆਦਾ ਬਦਲਾਅ ਹੈ ਅਤੇ ਪਹਿਲਾਂ ਵਾਲੀਆਂ ਨਾ ਗਰਮੀਆਂ ਆ ਅਤੇ ਨਾ ਹੀ ਪਹਿਲਾਂ ਵਾਲੀਆਂ ਸਰਦੀਆਂ ਆ ਪੱਕੀਆਂ ਫਸਲਾਂ 'ਤੇ ਪੈ ਕੇ ਗੜੇ ਅਤੇ ਗੜੇਮਾਰੀ ਨੇ ਫਸਲ ਦਾ ਤਬਾਹ ਕਰਨਾ ਅਤੇ ਜਿਹੜੇ ਵੀ ਕਿਸਾਨ ਆ ਉਹਨਾਂ ਨੂੰ ਆਪਦਾ ਟੈਸ਼ਨਾਂ ਦੇ ਵਿੱਚ ਅਤੇ ਉਹ ਆਪਦੀ ਮਜ਼ਦੂਰੀ ਵੀ ਜਿਹੜੀ ਵਿਚਾਰੇ ਕਰਦੇ ਨੇਗੇ ਖੇਤੀਬਾੜੀ ਅਤੇ ਉਹਨਾਂ ਨੂੰ ਇਹ ਗੱਲਾਂ ਲੈ ਕੇ ਅਤੇ ਫੇਰ ਬਹੁਤ ਟੈਸ਼ਨਾਂ ਹੋ ਜਾਂਦੀਆਂ ਅਤੇ ਬਹੁਤ ਹੀ ਬਦਲਾਅ